ਡਰਾਈਵਵੇਅ ਵਿੱਚ ਆਪਣੀ ਕਾਰ ਧੋਂਦੇ ਸਮੇਂ ਜਦੋਂ ਮੈਂ ਤੂਫ਼ਾਨੀ ਡ੍ਰੇਨ ਵਿੱਚ ਪਾਣੀ ਦੀ ਲਗਾਤਾਰ ਧਾਰਾ ਵੇਖਾਂਗਾ ਤਾਂ ਸਭ ਤੋਂ ਪਹਿਲਾਂ ਮੈਂ ਇਸ ਦੇ ਸਰੋਤ ਦੀ ਨਿਗਰਾਨੀ ਕਰਾਂਗਾ ਮੈਂ ਜਾਂਚ ਕਰਾਂਗਾ ਕਿ ਪਾਣੀ ਕਿਸ ਥਾਂ ਤੋਂ ਆ ਰਿਹਾ ਹੈ ਕਿ ਇਹ ਕੋਈ ਚੁੱਕੀ ਜਾਂ ਪਾਈਪ ਲੀਕ ਤਾਂ ਨਹੀਂ ਹੋ ਰਹੀ ਕੁਦਰਤੀ ਤਰੀਕੇ ਨਾਲ ਵਹਿ ਰਿਹਾ ਹੈ ਪਾਣੀ ਦਾ ਰੰਗ ਗੰਧ ਅਤੇ ਕਿਸੇ ਵੀ ਹੋਰ ਅਸਮਨ ਦੀ ਜਾਂਚ ਕਰਾਂ ਕਰਕੇ ਇਹ ਮੁਲਾਂਕਣ ਕਰਾਂਗਾ ਕੀ ਇਹ ਕੋਈ ਵੱਡਾ ਮੁੱਦਾ ਹੈ ਜੇਕਰ ਪਾਣੀ ਗੰਦਾ ਜਾਂ ਅਸਾਧਾਰਣ ਲੱਗੇ ਤਾਂ ਮੈਂ ਇਸ ਦੇ ਇਲਾਕੇ ਦੀ ਹੋਰ ਜਾਂਚ ਕਰਾਂਗਾ ਜਾਂਚ ਕਰਾਂਗਾ ਕਿ ਨੇੜਲੇ ਨਿਕ ਨਿਕਾਸ ਪੰਪ ਜਾਂ ਪਾਈਪਲਾਈਨ ਸਹੀ ਕੰਮ ਕਰ ਰਹੀ ਹਨ ਰਹੀਆਂ ਹਨ ਇਸ ਦੇ ਬਾਅਦ ਮੈਂ ਜਲ ਅਸਥਾਰਟੀ ਨਾ ਅਥੌਰਟੀ ਨਾਲ ਸੰਪਰਕ ਕਰਕੇ ਉਹਨਾਂ ਨੂੰ ਨਿਰੱਖਣ ਦੀ ਜਾਣਕਾਰੀ ਦਿਆਂਗਾ ਜਿਸ ਵਿੱਚ ਸਥਾਨ ਪਾਣੀ ਦੀ ਗੁਣਵੱਤਾ ਅਤੇ ਨੁਕਸਾਨ ਦੇ ਕਿਵੇਂ ਵੀ ਪਰਖਤ ਸੰਕੇਤ ਬਾਰੇ ਵੇਰਵੇ ਸ਼ਾਮਿਲ ਹੋਣਗੇ ਤਾਂ ਜੋ ਉਹ ਜ਼ਰੂਰੀ ਕਾਰਵਾਈ ਕਰ ਸਕਣ ਅਤੇ ਇਸ ਰਾਹੀਂ ਮੈਂ ਲੋਕਾਂ ਅਤੇ ਸਮਾਜ ਨੂੰ ਇਹ ਗੱਲ ਸਮਝਾਵਾਂਗਾ ਕਿ ਹਰ ਆਪਣੇ ਆਸ ਪਾਸ ਅਗਰ ਪਾਣੀ ਦੀ ਸੁਰੱਖਿਆ ਕਰਨੀ ਹੈ ਤਾਂ ਪਾਣੀ ਨੂੰ ਜਿੰਨਾਂ ਬਚਾ ਸਕਦੇ ਹੋਂ ਬਚਾਓ ਧੰਨਵਾਦ